ਹੈਲੋ ਹਾਂਜੀ ਸਰ ਕਿੱਥੇ ਹੋ ਅੱਛਾ ਸਰ ਜੀ ਮੈਂ ਤੁਹਾਡੇ ਕੋਲ ਇੱਥੇ ਘੁੰਮਣ ਆਉਣਾ ਸੀ ਜੀ ਹਾਂਜੀ ਸਰ ਜੀ ਹਾਂਜੀ ਪਛਾਣ ਲਿਆ ਜੀ ਵਧੀਆ ਸਰ ਜੀ ਬਹੁਤ ਬਹੁਤ ਵਧੀਆ ਜੀ ਇੱਧਰ ਕਿੱਦਾਂ ਦਾ ਮੌਸਮ ਹੈ ਜੀ ਅੱਛਾ ਜੀ ਠੀਕ ਹੈ ਮੈਂ ਮੈਂ ਆਉਣਾ ਸੀ ਜੀ ਘੁੰਮਣ ਹਾਂਜੀ ਪੰਜਾਬ ਵੱਲ ਜੀ ਹਾਂ ਹਾਂਜੀ ਹਾਂਜੀ ਸਰ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਫ਼ਤਹਿਗੜ੍ਹ ਸਾਹਿਬ ਆਉਣਾ ਜੀ ਹਾਂਜੀ ਅੱਛਾ ਜੀ ਕੱਪੜੇ ਠੰਡ ਦੇ ਲੈ ਕੇ ਆਈਏ ਜੀ ਅੱਛਾ ਜੀ ਓਕੇ ਸਰ ਸਰ ਮੈਂ ਅਤੇ ਮੇਰਾ ਪਰਿਵਾਰ ਹੈ ਜੀ ਹਾਂਜੀ ਹਾਂਜੀ ਇੱਥੋਂ ਕੀ ਇਤਿਹਾਸ ਹੈ ਸਰ ਜੀ ਅੱਛਾ ਜੀ ਅੱਛਾ ਜੀ

ਹਮ

ਹਮ

ਹਮ

ਅੱਛਾ ਜੀ

ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਸਰ ਠੀਕ ਹੈ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਜੀ